ਜ਼ਿਆਦਾਤਰ ਮੈਂ ਆਪਣੀਆਂ ਡਰੋਇੰਗਜ਼ ਦੇ ਵਿੱਚ ਜੋ ਕਾਰਟੂਨਸ ਨੇ ਉਹਨਾਂ ਨੂੰ ਬਣਾਉਣਾ ਪਸੰਦ ਕਰਦੀ ਹਾਂ ਉਸਦੇ ਦੋ ਕਾਰਨ ਨੇ ਇੱਕ ਤਾਂ ਕਾਰਟੂਨ ਬਣਾਉਣੇ ਸੌਖੇ ਵੀ ਹੁੰਦੇ ਨੇ ਹੂਬਹੂ ਬਣ ਵੀ ਜਾਂਦੇ ਨੇ ਅਤੇ ਦੂਸਰਾ ਉਸ ਨਾਲ਼ ਬਚਪਨ ਦੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਨੇ ਅਲੱਗ ਅਲੱਗ ਤਰ੍ਹਾਂ ਦੇ ਕਾਰਟੂਨਸ ਜੋ ਨੇ ਉਹ ਮੈਂ ਗੂਗਲ ਤੋਂ ਫੋਟੋਜ਼ ਲੈ ਕੇ ਡਰੋਅ ਕਰਦੀ ਹਾਂ ਅਤੇ ਕਈ ਵਾਰ ਕੁਝ ਖਾਸ ਵਿਸ਼ੇ ਅਤੇ ਥੀਮ ਇਹੋ ਜਿਹੇ ਹੁੰਦੇ ਨੇ ਜਿਵੇਂ ਕਿ ਇਨਵਾਇਰਮੈਂਟ ਡੇ ਹੋ ਗਿਆ ਜਾਂ ਫਿਰ ਕੋਈ ਖਾਸ ਮੈਸੇਜ ਜੋ ਹੈ ਉਹ ਬੱਚਿਆਂ ਤੱਕ ਪਹੁੰਚਾਉਣਾ ਹੈ ਤਾਂ ਇੱਦਾਂ ਦੇ ਵੱਖ ਵੱਖ ਕੋਂਪੀਟੀਸ਼ਨ ਜੋ ਨੇ ਉਹ ਸਾਡੇ ਕੋਲਿਜ ਦੇ ਵਿੱਚ ਆਯੋਜਿਤ ਕੀਤੇ ਜਾਂਦੇ ਨੇ ਜਿਸ ਵਿੱਚ ਮੈਂ ਭਾਗ ਲੈਣਾ ਬਹੁਤ ਪਸੰਦ ਕਰਦੀ ਹਾਂ ਆਪਣੇ ਡਰੋਇੰਗਜ਼ ਦੇ ਦੁਆਰਾ ਇੱਕ ਸਮਾਜ ਨੂੰ ਮੈਸੇਜ ਦੇਣਾ ਜੋ ਹੈ ਉਹ ਮੈਨੂੰ ਬਹੁਤ ਪਸੰਦ ਹੈ ਕਾਰਟੂਨਜ਼ ਦਾ ਯੂਜ਼ ਕਰਕੇ ਜਾਂ ਫਿਰ ਅਲੱਗ ਅਲੱਗ ਤਰ੍ਹਾਂ ਦੇ ਚਿੱ ਚਿੱਤਰ ਵਰਨਨ ਕਰਕੇ ਸੇਵ ਵੋਟਰ ਦਾ ਜੋ ਹੈ ਪਾਣੀ ਨੂੰ ਬਚਾਉਣ ਦਾ ਜਾਂ ਫਿਰ ਦਰੱਖਤਾਂ ਨੂੰ ਨਾ ਕੱਟਣ ਦਾ ਇਹੋ ਜਿਹੇ ਚੰਗੇ ਜੋ ਮੈਸੇਜ ਨੇ ਉਹ ਬੱਚਿਆਂ ਨੂੰ ਆਸਾਨੀ ਨਾਲ ਦਿੱਤੇ ਜਾ ਸਕਦੇ ਨੇ